ਮੈਨੂੰ ਹੀਰੋ ਹੌਂਡਾ ਦਰੀਮ ਜੂਵਾ ਮੋਟਰਸਾਇਕਲ ਚਲਾਉਂਣਾ ਪਸੰਦ ਹੈ ਕਿਉਂਕਿ ਆ ਮੈਂ ਇਸ ਚੀਜ਼ ਦਾ ਮਾਲਕ ਖ਼ੁਦ ਦਾ ਮਾਲਕ ਹਾਂ ਦਰੀਮ ਜੂਵੇ ਦਾ ਅਤੇ ਇਹ ਚਲਾਉਣ 'ਚ ਬਹੁਤ ਹੀ ਆਰਾਮਦਾਇਕ ਹੈ ਇਹਦੀ ਸਰਵਿਸਿਸ ਦਾ ਖ਼ਰਚਾ ਵੀ ਬਹੁਤ ਘੱਟ ਆਉਂਦਾ ਹੈ ਅਤੇ ਐਵਰੇਜ ਇਹਦੀ ਬਹੁਤ ਬਹੁਤ ਬਹੁਤ ਵਧੀਆ ਹੈ ਐਵਰੇਜ ਇਹਦੀ ਇਹ ਘੱਟ ਤੋਂ ਘੱਟ ਆਪਾਂ ਨੂੰ ਸੱਤਰ ਅੱਸੀ ਦੇ ਨੇੜੇ ਐਵਰੇਜ ਦੇ ਦਿੰਦਾ ਹੈ ਅਤੇ ਇਹ ਚਲਾਉਣ 'ਚ ਆਰਾਮਦਾਇਕ ਹੈ ਅਤੇ ਇਹਦੇ ਨਾਲ ਪਤਾ ਨਹੀਂ ਲੱਗਦਾ ਆਪਾਂ ਕਿੰਨੇ ਕਿਲੋਮੀਟਰ ਜਾ ਰਹੇ ਹਾਂ ਕਿਉਂਕਿ ਇਹਨਾਂ 'ਚ ਅਜਿਹੀਆਂ ਚੀਜ਼ਾਂ ਜੇ ਆਪਣਾ ਐਕਸੀਡੈਂਟ ਵੀ ਬਾਈ ਚੈਂਸ ਐ ਐਕਸੀਡੈਂਟ ਹੋ ਜਾਂਦੇ ਹੈ ਅਤੇ ਇਹਦੇ 'ਚ ਆਪਾਂ ਨੂੰ ਟੁੱਟਣ ਦਾ ਖ਼ਤਰਾ ਬਹੁਤ ਘੱਟ ਹੁੰਦਾ ਇਹਦਾ ਨਾਲੇ ਆਪਣੇ ਸਰੀਰ ਨੂੰ ਵੀ ਬਚਾਉਂਦਾ ਕਿਉਂਕਿ ਇਹਦੀ ਜਿੰਨਾ ਵੀ ਇਹਦਾ ਮਟੀਰੀਅਲ ਲੱਗਿਆ ਹੈ ਸਾਰਾ ਲੋ ਲੋਹੇ ਦਾ ਲੱਗਿਆ ਹੋਇਆ ਹੈ ਇੱਦਾਂ ਨਹੀਂ ਕੋਈ ਪਲਾਸਟਿਕ ਲੱਗੇ ਸਾਰਾ ਮਟੀਰੀਅਲ ਲੋਹੇ ਦਾ ਹੈ ਇਹਦੇ ਕਰਕੇ ਆਪਾਂ ਨੂੰ ਇਹਦਾ ਬਹੁਤ ਫ਼ਾਇਦਾ ਹੈ ਇਹ ਇੱਕ ਇਹ ਪਹਾੜਾਂ 'ਚ ਘੁੰਮਣ ਲਈ ਬਹੁਤ ਆਰਾਮਦਾਇਕ ਹੈ ਕਿਉਂਕਿ ਪਹਾੜਾਂ ਹੁੰਦੇ ਉੱਚੀ ਆ ਉਹਦੇ ਕਰਕੇ ਆਪਾਂ ਨੂੰ ਆਹ ਤਾਂ ਜੋ ਮਿੰਟਾਂ 'ਚ ਤਾਂਹ ਨੂੰ ਚੜ੍ਹਾਈ ਵਗੈਰਾ ਚੜ੍ਹ ਜਾਂਦਾ ਹੈ ਅਤੇ ਐਵਰੇਜ ਵੀ ਇਹਦੀ ਬਹੁਤ ਵਧੀਆ ਆਰਾਮਦਾਇਕ ਇਹ ਸਰੀਰ ਲਈ ਆਪਣੇ ਲਈ ਅਤੇ ਨਾਲ ਇਹ ਬੈਕ ਬੈਕ ਤੋਂ ਬਹੁਤ ਵਧੀਆ ਹੈ ਅਤੇ ਜੋ ਇਹਦੀ ਆਪਣਾ